ਸਾਨੂੰ ਘਰ ਹਰ ਟਾਈਮ ਜਦੋਂ ਵੀ ਧੋਣਾ ਹੈ ਅਤੇ ਫਰਨੈਲ ਪਾ ਕੇ ਹੀ ਧੋਣਾ ਹੈ ਇਸ ਨਾਲ ਫਰਸ਼ 'ਤੇ ਕੋਈ ਜਰਮ ਨਹੀਂ ਰਹਿੰਦਾ ਅਤੇ ਕੀਟਨਾਸ਼ਕ ਹੋ ਜਾਂਦਾ ਹੈ ਇਸ ਕਰਕੇ ਫਰਸ਼ ਨੂੰ ਪੂਰਾ ਆਪਣੇ ਘਰ ਨੂੰ ਸਾਫ ਸੁਪਾ ਰੱਖਣਾ ਚਾਹੀਦਾ ਹੈ ਇਸ ਜਿਵੇਂ ਛੋਟੇ ਬੱਚਿਆਂ ਨਾਲ ਘਰ ਵਿੱਚ ਫਿਰਨਾ ਹੈ ਤਾਂ ਉਹਨਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਤਾਂ ਅਸੀਂ ਜਦੋਂ ਵੀ ਫਰਸ਼ ਧੋਣਾ ਹੈ ਤਾਂ ਫਰਨੈਲ ਪਾ ਕੇ ਹੀ ਧੋਣਾ ਹੈ ਹੁਣ ਉਹ ਘਰ ਪਹਿਲਾਂ ਅਸੀਂ ਉਸ ਦੀ ਵਰਤੋਂ ਕਰ ਕਾਉ ਡੰਕ ਦੀ ਵਰਤੋਂ ਕਰਦੇ ਸੀ ਕਿਉਂਕਿ ਘਰ ਕੱਚੇ ਹੁੰਦੇ ਸਨ ਪਰ ਇਸ ਹੁਣ ਵਰਤੋਂ ਨਹੀਂ ਕਰਦੇ ਕਿਉਂਕਿ ਘਰ ਪੱਕੇ ਹਨ ਇਸ ਕਰਕੇ ਹੁਣ ਅਸੀਂ ਸਾਫ ਸਫਾਈ ਦਾ ਪੂਰਾ ਧਿਆਨ ਰੱਖਦੇ ਹਾਂ ਅਤੇ ਇਸ ਲਈ ਸਾਨੂੰ ਅਸੀਂ ਫਰਨੈਲ ਦਾ ਹੀ ਪੋਚਾ ਲਾਉਂਦੇ ਹਾਂ ਅਤੇ ਕਦੇ ਇਹ ਨਹੀਂ ਹੁੰਦਾ ਕਿ ਪੀ ਅਸੀਂ ਫਰਨੈਲ ਪਾ ਕੇ ਪੋਚਾ ਨਾ ਲਾਈਏ ਹਰ ਰੋਜ਼ ਪੋਚਾ ਲਾਉਣ ਵੇਲੇ ਅਸੀਂ ਫਰਨੈਲ ਜ਼ਰੂਰ ਪਾਉਂਦੇ ਹਾਂ ਸਪ ਸਾਡੇ ਘਰ ਨੂੰ ਸਾਫ ਸੁਥਰਾ ਰੱਖਣਾ ਸਾਡਾ ਹੀ ਹੱਕ ਬਣਦਾ ਹੈ ਇਸ ਲਈ ਸਾਨੂੰ ਸਾਫ ਸਫਾਈ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ ਬੱਚਿਆਂ 'ਤੇ ਬਜ਼ੁਰਗਾਂ ਲਈ ਸਾਫ ਸਫਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਕਿ ਇੱਥੇ ਸਾਡੇ ਬਜ਼ੁਰਗ ਪਏ ਹਨ ਜਾਂ ਸਾਡੇ ਬੱਚੇ ਫਿਰ ਰਹੇ ਹਨ ਇਸ ਲਈ ਸਾਨੂੰ ਸਾਫ ਸਫਾਈ ਫਰਨੈਲ ਪਾ ਕੇ ਹੀ ਕਰਨਾ ਚਾਹੀਦਾ ਹੈ ਅਤੇ ਆਪਣੇ ਘਰ ਨੂੰ ਸਾਫ ਅਤੇ ਆਪਣੇ ਘਰ ਨੂੰ ਸਾਫ ਰੱਖਣ ਵਿੱਚ ਹਰ ਟਾਈਮ ਧਿਆਨ ਦੇਣਾ ਚਾਹੀਦਾ ਹੈ ਘਰ ਵਿੱਚ ਕੋਈ ਵੀ ਗੰਦ ਮੰਦ ਨਹੀਂ ਰੱਖਣਾ ਚਾਹੀਦਾ ਅਤੇ ਸਾਨੂੰ ਸਾਫ ਸਫਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਜਦੋਂ ਵੀ ਅਸੀਂ ਪੋਚਾ ਲਾਈਏ ਉਸ ਨੂੰ ਚੰਗਾ ਚੰਗੀ ਤਰ੍ਹਾਂ ਸੁਕਾ ਕੇ ਲਾਈਏ ਕਿਉਂਕਿ ਕੋਈ ਸਮੈਲ ਵਗੈਰਾ ਨਾ ਆਵੇ ਜੇ ਅਸੀਂ ਫਰਨੈਲ ਪਾ ਕੇ ਪੋਚਾ ਲਾਉਂਦੇ ਹਾਂ ਤਾਂ ਸਾਡੇ ਘਰ ਵਿੱਚ ਵਧੀਆ ਸਮੈਲ ਆਉਂਦੀ ਹੈ ਅਤੇ ਕੀੜੇ ਮਕੌੜਿਆਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਕੀੜੇ ਮਕੌੜੇ ਵੀ ਨਹੀਂ ਆਉਂਦੇ ਇਸ ਲਈ ਸਾਨੂੰ ਫਰਨੈਲ ਪਾ ਕੇ ਪੋਚਾ ਲਾਉਣਾ ਚਾਹੀਦਾ ਹੈ ਅਤੇ ਸਾਨੂੰ ਆਪਣੇ ਘਰ ਦੀ ਸਾਫ ਸਫਾਈ ਦਾ ਆਪ ਨੂੰ ਧਿਆਨ ਰੱਖਣਾ ਚਾਹੀਦਾ ਹੈ